ਮੈਨੂੰ ਰੋਜ਼ ਸੁਬਹਾ ਦੌੜਨਾ ਬਹੁਤ ਪਸੰਦ ਹੈ ਮੈਂ ਦੌੜਨ ਦੌੜਦੇ ਵਕਤ ਜ਼ਿਆਦਾਤਰ ਆਪਣਾ ਧਿਆਨ ਕੇਂਦਰਿਤ ਹੀ ਰੱਖਦਾ ਹਾਂ ਮੇਰਾ ਮੰਨਣਾ ਮੇਰਾ ਮੰਨਣਾ ਹੈ ਕਿ ਜ਼ਿਆਦਾ ਧਿਆਨ ਕੇਂਦਰਿਤ ਕਰਨ ਲਈ ਆਪਾਂ ਨੂੰ ਉਸ ਚੀਜ਼ ਵੱਲ ਜ਼ਿਆਦਾ ਫੋਕਸ ਕਰਨਾ ਕਰਨ ਦੀ ਲੋੜ ਹੈ ਜੋ ਆਪਣੇ ਲਈ ਜ਼ਰੂਰੀ ਹੈ ਮੈਂ ਪੋਡਕਾਸਟ ਜਾਂ ਸੰਗੀਤ ਘੱਟ ਹੀ ਸੁਣਦਾ ਹਾਂ ਪਰ ਜੇ ਕਦੇ ਲੋੜ ਪਵੇ ਤਾਂ ਮੈਂ ਪੋਡਕਾਸਟ ਸੁਣਨ ਲਈ ਚੈਨਲ ਤੋਂ ਪੋਡਕਾਸਟ ਸੁਣਦਾ ਹਾਂ ਉਹਨਾਂ ਦੇ ਪੋਡਕਾਸਟ ਮੈਨੂੰ ਵਧੀਆ ਅਤੇ ਇੰਟਰਸਟਿੰਗ ਲੱਗਦੇ ਹਨ ਸੰਗੀਤ ਦੇ ਪੱਖੋਂ ਮੈਨੂੰ ਹਿੱਪ ਹੋਪ ਸੰਗੀਤ ਬਹੁਤ ਸੰਗੀਤ ਬਹੁਤ ਪਸੰਦ ਹੈ ਹਿੱਪ ਹੋਪ ਸੰਗੀਤ ਦਾ ਰਾਜਾ ਆਪਾਂ ਟੂ ਪਾਕ ਨੂੰ ਕਹਿ ਸਕਦੇ ਹਾਂ ਅਤੇ ਹੋਰ ਸੰਗੀਤ ਸੁਣਨ ਲਈ ਮੈਂ ਕੁਝ ਮੋਟੀਵੇਸ਼ਨਲ ਸੋਂਗ ਸੁਣਦਾ ਹਾਂ ਜਿਸ ਲਈ ਜਿਸ ਨਾਲ ਮੈਨੂੰ ਭੱਜਣ ਲਈ ਪ੍ਰੇਰਨਾ ਮਿਲਦੀ ਹੈ ਮੋਟੀਵੇਸ਼ਨਲ ਸੌਂਗ ਮੈਨੂੰ ਭੱਜਣ ਲਈ ਉਤਸ਼ਾਹਿਤ ਕਰਦੇ ਹਨ ਮੈਂ ਆਪਣਾ ਫੋਕਸ ਵਧਾਉਣ ਲਈ ਆਪਣਾ ਫ਼ੋਕਸ ਬਣਾਉਣ ਲਈ ਇੱਕ ਜਗ੍ਹਾ ਤੇ ਕੇਂਦਰਿਤ ਰਹਿੰਦਾ ਹਾਂ ਮੈਂ ਆਪਣੀਆਂ ਲੱਤਾਂ ਅਤੇ ਆਪਣੇ ਸਰੀਰ ਦੀ ਪੁਜੀਸ਼ਨ ਨੂੰ ਸਹੀ ਰੱਖਦਾ ਹਾਂ ਤਾਂ ਜੋ ਮੇਰਾ ਫ਼ੋਕਸ ਸਹੀ ਭੱਜਣ 'ਤੇ ਬਣਿਆ ਰਹੇ